ਇੱਕ ਤੈਰਾਕੀ ਜਦੋਂ ਕਿਸੇ ਪੂਲ ਵਿੱਚ ਤੈਰਦਾ ਹੈ ਤਾਂ ਉਸ ਪੂਲ ਵਿੱਚ ਉਸ ਤੈਰਾਕੀ ਦੀਆਂ ਸੁਰੱਖਿਆਵਾਂ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਕਿ ਉਸ ਤੈਰਾਕੀ ਨੂੰ ਤਿਲ ਅ ਤੈਰਨ ਸਮੇਂ ਕੋਈ ਵੀ ਸਮੱਸਿਆ ਨਾ ਆਉਣ ਅਤੇ ਉਸ ਦਾ ਪੈਰ ਵਗੈਰਾ ਨਾ ਤਿਲਕੇ ਅਤੇ ਉਸ ਦੇ ਸੱਟ ਚੋਟ ਨਾ ਲੱਗੇ ਪਰ ਜਦੋਂ ਉਹੀ ਤੈਰਾਕੀ ਬੰਦਾ ਕਿਸੇ ਖੁੱਲ੍ਹੇ ਤੈਲਾਬ ਵਿੱਚ ਤੈਰਦਾ ਹੈ ਤਾਂ ਉਸ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਵੇਂ ਕਿ ਉੱਥੇ ਚਟਾਨਾਂ ਦੇ ਉੱਤੇ ਐਲਗੀ ਆਦਿ ਹੁੰਦੀ ਹੈ ਜਿਸ ਕਾਰਨ ਉਸ ਦਾ ਪੈਰ ਤਿਲਕ ਸਕਦਾ ਹੈ ਤੇਜ਼ ਵਹਾਅ ਜੇਕਰ ਪਾਣੀ ਦਾ ਤੇਜ਼ ਵਹਾਅ ਆ ਗਿਆ ਤਾਂ ਉਸ ਬੰਦਾ ਪਾਣੀ ਵਿੱਚ ਡੁੱਬ ਵੀ ਸਕਦਾ ਹੈ ਤਾਂ ਉਸ ਦੀ ਜਾਨ ਜੋ ਜਾ ਸਕਦੀ ਹੈ ਤੋ ਇਸੇ ਲਈ ਸੁ ਤੈਰਾਕੀ ਬੰਦੇ ਨੂੰ ਜਿਹੜਾ ਕਿ ਸਵਿਮਿੰਗ ਪੂਲ ਵਿੱਚ ਹੀ ਤੈਰਨਾ ਚਾਹੀਦਾ ਹੈ ਨਾ ਕਿ ਤੇਜ਼ ਖੁੱਲ੍ਹੇ ਜਿਹੜੇ ਕਿ ਖੁੱਲ੍ਹੇ ਮੈਦਾਨ ਵਿੱਚ ਪਾਣੀ ਦੇ ਤਾਂ ਕਿ ਉਸ ਨੂੰ ਕੋਈ ਸਮੱਸਿਆਵਾਂ ਨਾ ਆਉਣ